ਮੌਜੂਦਾ ਸਮੇਂ ਵਿੱਚ ਵਿਗਿਆਪਨ ਦੇ ਕਈ ਤਰੀਕੇ ਹਨ ਜਿਨ੍ਹਾਂ ਨਾਲ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕਦੇ ਹਾਂ ਸੋਸ਼ਲ ਮੀਡੀਆ ਇੰਟਰਨੈੱਟ ਟੀ ਵੀ ਰੇਡੀਓ ਨਿਊਸਪੇਪਰ ਔਰ ਬਿਲਬੋਰਡ ਸਭ ਇੰਪੋਰਟੈਂਟ ਨੇ ਅੱਜ ਕੱਲ੍ਹ ਟਾਰਗੇਟ ਐਡਵਰਟਾਈਜਮੈਂਟ ਬਹੁਤ ਪਾਪੂਲਰ ਹੈ ਇਹਦਾ ਮਤਲਬ ਹੈ ਕਿ ਤੁਸੀਂ ਸਿਰਫ਼ ਉਹਨਾਂ ਲੋਕਾਂ ਨੂੰ ਹੀ ਵਿਗਿਆਪਨ ਦਿਖਾ ਸਕਦੇ ਹੋ ਜਿਨਾਂ ਨੂੰ ਉਸ ਚੀਜ਼ ਵਿੱਚ ਰੁਚੀ ਹੈ ਮਿਸਾਲ ਲਈ ਅਗਰ ਤੁਸੀਂ ਸਪੋਟਸ ਸ਼ੂਜ਼ ਵੇਚ ਰਹੇ ਹੋ ਤੁਸੀਂ ਆਪਣਾ ਵਿਗਿਆਪਨ ਸਿਰਫ਼ ਉਹਨਾਂ ਲੋਕਾਂ ਨੂੰ ਦਿਖਾ ਸਕਦੇ ਹੋ ਜੋ ਫਿਟਨੈਸ ਜਾਂ ਸਪੋਰਟਸ ਵਿਚ ਇੰਟਰਸਟਿਡ ਹਨ ਮੈਨੂੰ ਯਾਦ ਹੈ ਇੱਕ ਐਡਵਰਟਾਈਜਮੈਂਟ ਨਾਇਕ ਦੀ ਸੀ ਉਹਨਾਂ ਨੇ ਇੱਕ ਵੀਡੀਓ ਬਣਾਈ ਸੀ ਜਿਸ ਵਿੱਚ ਉਹਨਾਂ ਨੇ ਇੱਕ ਲੜਕਾ ਦਿਖਾਇਆ ਸੀ ਜੋ ਉਨ੍ਹਾਂ ਦੇ ਬੂਟ ਪਾ ਕੇ ਦੌੜ ਰਿਹਾ ਸੀ ਅਤੇ ਪਹਿਲੇ ਸਥਾਨ ਵਿੱਚ ਪਹੁੰਚ ਗਿਆ ਇਹ ਐਡਵਰਟਾਈਜਮੈਂਟ ਮੈਨੂੰ ਬਹੁਤ ਪ੍ਰਭਾਵਸ਼ਾਲੀ ਲੱਗੀ ਸੀ ਕਿਉਂਕਿ ਇਹ ਲੋਕਾਂ ਨੂੰ ਇੰਸਪਾਇਰ ਕਰਦੀ ਸੀ ਔਰ ਉਹਨਾਂ ਨੂੰ ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਲਈ ਅੱਗੇ ਵੱਧਦੀ ਸੀ ਇਹ ਵਿਗਿਆਪਨ ਕਰੇਟਿਵ ਵੀ ਸੀ ਔਰ ਇਸ ਵਿੱਚ ਮੇਰੀ ਸੋਚ ਵੀ ਬਦਲ ਦਿੱਤੀ